ਪੰਜਾਬੀ ਸੱਭਿਆਚਾਰ ਵਿੱਚ ਵਿਆਹਾਂ ਦੇ ਰੀਤੀ ਰਿਵਾਜ਼ ਹਨ ਜਿਵੇਂ ਮੁੰਡੇ ਦੇ ਵਿਆਹ ਦੇ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਹਨ ਜਦ ਕਿ ਕੁੜੀ ਦੇ ਵਿਆਹ ਦੇ ਸਮੇਂ ਸੁਹਾਗ ਗਾਏ ਜਾਂਦੇ ਹਨ ਇਸ ਤੋਂ ਇਲਾਵਾ ਮੁੰਡੇ ਦੇ ਵਿਆਹ ਦੇ ਸਮੇਂ ਭਾਬੀਆਂ ਵੱਲੋਂ ਮੁੰਡੇ ਨੂੰ ਸੁਰਮਿਆਂ ਸੁਰਮਾ ਪਾਇਆ ਜਾਂਦਾ ਹੈ ਅਤੇ ਕੁੜੀ ਦ ਦੇ ਵਿਆਹ ਦੇ ਸਮੇਂ ਜਦੋਂ ਬਰਾਤ ਆਉਂਦੀ ਹੈ ਤਾਂ ਉਦੋਂ ਜੀਜਾ ਸਾਲੀ ਨੂੰ ਕੁਝ ਸ਼ਗਨ ਦਿੰਦਾ ਹੈ ਅਤੇ ਫਿਰ ਰਿਬਨ ਕਟਾਈ ਦੀ ਰਸਮ ਹੁੰਦੀ ਹੈ